ਤੁਸੀਂ ਜੰਗਲੀ ਪੰਛੀਆਂ ਬਾਰੇ ਗੱਲ ਕਰਦੇ ਹੋ ਤਾਂ ਮੈਂ ਕਹਿਣਾ ਚਾਹਵਾਂਗੀ ਜੰਗਲ ਵਿੱਚ ਵੀ ਜੰਗਲਾਂ ਵਿੱਚ ਵੀ ਕਈ ਤਰ੍ਹਾਂ ਦੇ ਪੰਛੀ ਹੁੰਦੇ ਆ ਜਿਵੇਂ ਕਿ ਉੱਲੂ ਹੁੰਦਾ ਹੈ ਬਾਜ ਹੁੰਦਾ ਹੈ ਮੁਰਗਾਬੀ ਹੁੰਦੀ ਹੈ ਬੜੀ ਸੋਹਣੇ ਸੋਹਣੇ ਤਰ੍ਹਾਂ ਦੇ ਪੰਛੀ ਹੁੰਦੇ ਹਨ ਉੱਲੂ ਹੁੰਦਾ ਹੈ ਉੱਲੂ ਜਿਹੜਾ ਕਿ ਰਾਤ ਨੂੰ ਦੇਖਦਾ ਹੈ ਅਤੇ ਦਿਨ ਵੇਲੇ ਨਹੀਂ ਦੇਖ ਸਕਦਾ ਮੁਰਗਾਬੀ ਹੁੰਦੀ ਮੁਰਗਾਬੀ ਕਈ ਤਰ੍ਹਾਂ ਦੇ ਰੰਗਾਂ ਦੀ ਹੁੰਦੀ ਹੈ ਉਹਨੂੰ ਵੇਖਣਾ ਬੜਾ ਸੋਹਣਾ ਲੱਗਦਾ ਹੈ ਉਹ ਜੰਗਲ ਦੇ ਵਿੱਚ ਬੱਤਖ ਦੀ ਤੋਰ ਵਾਂਗੂ ਤੁਰਦੀ ਹੈ ਆਲੇ ਦੁਆਲੇ ਇੱਕ ਇੱਕ ਵੁੱਡਪੈਕਰ ਹੁੰਦੀ ਹੈ ਜਿਹੜੀ ਲੱਕੜ ਨੂੰ ਹਰ ਵੇਲੇ ਟੁੱਕ ਟੁੱਕ ਕਰਦੀ ਰਹਿੰਦੀ ਹੈ ਜੰਗਲ ਦੇ ਜਿੰਨੇ ਵੀ ਦਰੱਖਤ ਹੁੰਦੇ ਹਨ ਉਹਨਾਂ ਨੂੰ ਟੁੱਕ ਟੁੱਕ ਕਰਕੇ ਦੇਖਦੀ ਹੈ ਇੱਕ ਵਾਰੀ ਮੈਂ ਜੰਗਲ ਦੇ ਵਿੱਚ ਗਈ ਸੀ ਤਾਂ ਉੱਥੇ ਮੈਂ ਉੱਲੂ ਦੇਖਿਆ ਖੇਤ ਖੇਤ ਵਿੱਚ ਵੀ ਬੈਠਾ ਸੀ ਮੋਰ ਬੈਠੇ ਹੋਏ ਸਨ ਮੋਰ ਜਿਹੜੇ ਹਰ ਵੇਲੇ ਪੈਲਾਂ ਪਾਉਂਦੇ ਰਹਿੰਦੇ ਨੇ ਜੰਗਲ ਵਿੱਚ ਉਹਨਾਂ ਨੂੰ ਹਰਿਆਲੀ ਚੰਗੀ ਲੱਗਦੀ ਹੈ ਉੱਲੂ ਜਿਹੜਾ ਕਿ ਰਾਤ ਨੂੰ ਹੀ ਸ਼ਿਕਾਰ ਕਰਦਾ ਹੈ ਰਾਤ ਨੂੰ ਜਾਗ ਕੇ ਉਹ ਸ਼ਿਕਾਰ ਕਰਦਾ ਹੈ ਚਮਗਾਦੜ ਹੁੰਦੀ ਹੈ ਜੰਗਲਾਂ ਦੇ ਵਿੱਚ ਜਿਹੜੀ ਕਿ ਆਪਣਾ ਰਾਤ ਨੂੰ ਹੀ ਸ਼ਿਕਾਰ ਕਰਦੀ ਹੈ ਇਹ ਜੰਗਲਾਂ ਦੇ ਜਾਨਵਰ ਹੁੰਦੇ ਹਨ ਜੋ ਕਿ ਰਾਤ ਨੂੰ ਹੀ ਜੰਗਲਾਂ ਵਿੱਚ ਨਜ਼ਰ ਆਉਂਦੇ ਆ ਦਿਨ ਵੇਲੇ ਛੁਪ ਜਾਂਦੇ ਹਨ ਸਾਨੂੰ ਰਾਤ ਦੇ ਜੰਗਲੀ ਪੰ ਰਾਤ ਦੇ ਜਿਹੜੇ ਪੰਛੀ ਹੁੰਦੇ ਆ ਉਹਨਾਂ ਨੂੰ ਦੇਖ ਕੇ ਬੜਾ ਚੰਗਾ ਲੱਗਦਾ ਹੈ ਮ ਜੰਗਲੀ ਪੰਛੀਆਂ ਦੇ ਵਿੱਚ ਮੁਰਗਾਬੀ ਆਲੇ ਦੁਆਲੇ ਹਰ ਵੇਲੇ ਪੈਲਾਂ ਪਾਉਂਦੀ ਰਹਿੰਦੀ ਹੈ ਉਹਨਾਂ ਨੂੰ ਦੇਖਣਾ ਸਾਨੂੰ ਬੜਾ ਸੋਹਣਾ ਲੱਗਦਾ ਹੈ